ਬਿਮਾਰੀਆਂ ਤੋਂ ਬਚਣ ਲਈ ਅਸੀਂ ਚੰਗੀ ਜਿਵੇਂ ਖਾਣ ਪੀਣਾ ਚੰਗਾ ਰੱਖਦੇ ਹੈ ਅਤੇ ਬਿਮਾਰੀਆਂ ਤੋਂ ਬਚਣ ਲਈ ਵਧੀਆ ਖਾ ਕੇ ਅਸੀਂ ਕਸਰਤ ਵੀ ਕਰਦੇ ਹਾਂ ਜਿਵੇਂ ਸਾਡਾ ਕੋਈ ਬੰਦਾ ਬਿਮਾਰ ਹੋ ਜਾਂਦਾ ਮਰੀਜ਼ ਤਾਂ ਅਸੀਂ ਉਹਨੂੰ ਅਲੱਗ ਕਮਰੇ ਦੇ ਵਿੱਚ ਕਰ ਦਿੰਦੇ ਹਾਂ ਉਹਦਾ ਅਲੱਗ ਹੀ ਅਸੀਂ ਉਹਨਾਂ ਦਾ ਖਾਣਾ ਪਹੁੰਚਾਉਂਦੇ ਹਾਂ ਅਤੇ ਅਸੀਂ ਆਪਣੇ ਘਰ ਦੇ ਆਲ਼ੇ ਦੁਆਲੇ ਸਾਫ਼ ਸਫ਼ਾਈ ਆ ਸਾਫ਼ ਸਫ਼ਾਈ ਰੱਖਦੇ ਹਾਂ ਅਤੇ ਜਿਵੇਂ ਕਿ ਕੋਈ ਪਾਣੀ ਸਾਫ਼ ਪਾਣੀ ਦੇ ਉੱਤੇ ਡੇਂਗੂ ਪੈਦਾ ਹੋ ਜਾਂਦਾ ਸੀ ਉਹ ਵੀ ਨਹੀਂ ਖੜ੍ਹਨ ਦਿੰਦੇ ਅਤੇ ਜਿਵੇਂ ਗੰਦਾ ਪਾਣੀ ਆ ਤਾਂ ਮਲੇਰੀਆ ਹੋ ਜਾਂਦਾ ਅਤੇ ਉਹ ਵੀ ਅਸੀਂ ਸਾਫ਼ ਰੱਖਦੇ ਹਾਂ ਅਤੇ ਖਾਣ ਪੀਣ ਵੀ ਅਸੀਂ ਵਧੀਆ ਰੱਖਦੇ ਜਿਵੇਂ ਕਿ ਤਾਜ਼ੀਆਂ ਸਬਜ਼ੀਆਂ ਖਾਂਦੇ ਹਾਂ ਅਤੇ ਵਧੀਆ ਆਪਣੇ ਘਰ ਦਾ ਦੁੱਧ ਪੀਂਦੇ ਹਾਂ ਅਤੇ ਹੋਰ ਜਿਵੇਂ ਫਿਲਟਰ ਵਾਲਾ ਪਾਣੀ ਪੀਂਦੇ ਹਾਂ ਅਤੇ ਅੱਛੀ ਆਪਣੀ ਸੰਭਾਲ ਰੱਖਦੇ ਹਾਂ